ਨਹੀਂ ਮੈਨੂੰ ਪੰਜਾਬੀ ਲਿਖਣ ਜਾਂ ਬੋਲਣ ਵਿੱਚ ਕਦੇ ਵੀ ਕੋਈ ਵੀ ਮੁਸ਼ਕਿਲ ਨਹੀਂ ਆਈ ਕਿਉਂਕਿ ਪੰਜਾਬੀ ਸਾਡੀ ਮਾਂ ਬੋਲੀ ਹੈ ਮਾਂ ਭਾ ਮਾਤ ਭਾਸ਼ਾ ਹੈ ਇਹ ਸਾਡੇ ਨਾਲ ਮੁੱਢ ਤੋਂ ਚੱਲੀ ਆ ਰਹੀ ਹੈ ਬਚਪਨ ਦੇ ਵਿੱਚ ਹੀ ਸਾਨੂੰ ਘਰ ਦੇ ਵਿੱਚ ਦਾਦਾ ਦਾਦੀ ਮ ਮਾਂ ਬਾਪ ਮਾਸੜ ਮਾਸੀ ਚਾਚਾ ਚਾਚੀ ਦਾਦਾ ਦਾਦੀ ਨਾਨਾ ਨਾਨੀ ਸਾਰੇ ਬੋਲਣਾ ਸਿਖਾ ਦਿੰਦੇ ਹਨ ਉਸ ਤੋਂ ਬਾਅਦ ਫੇਰ ਜਦੋਂ ਅਸੀਂ ਸਕੂਲ ਵਿੱਚ ਜਾਂਦੇ ਹਾਂ ਉੱਥੇ ਵੀ ਸਾਨੂੰ ਚੰਗੀ ਤਰ੍ਹਾਂ ਸਿਖਾਇਆ ਜਾਂਦਾ ਹੈ ਕਿ ਕਿਵੇਂ ਪੰਜਾਬੀ ਨੂੰ ਲਿਖਣਾ ਹੈ ਅਤੇ ਕਿਵੇਂ ਪੰਜਾਬੀ ਨੂੰ ਬੋਲਣਾ ਹੈ ਹੁਣ ਤਾਂ ਸਰਕਾਰਾਂ ਨੇ ਵੀ ਪੰਜਾਬੀ ਨੂੰ ਲਾਜ਼ਮੀ ਵਿਸ਼ਾ ਬਣਾ ਦਿੱਤਾ ਹੈ ਸਕੂਲਾਂ ਦੇ ਵਿੱਚ ਉਹ ਕੋਈ ਵੀ ਬੱਚਾ ਜੋ ਪੰਜਾਬੀ ਦੇ ਵਿੱਚ ਪਾਸ ਨਹੀਂ ਹੋਵੇਗਾ ਉਸਨੂੰ ਬਾਕੀ ਸਾਰੇ ਵਿਸ਼ਿਆਂ ਦੇ ਵਿੱਚ ਵੀ ਫੇਲ ਹੀ ਮੰਨਿਆ ਜਾਵੇਗਾ ਇਸ ਕਰਕੇ ਪੰਜਾਬੀ ੲ ਸਕੂਲਾਂ ਦੇ ਵਿੱਚ ਵੀ ਇੱਕ ਲਾਜ਼ਮੀ ਵਿਸ਼ਾ ਬਣ ਚੁੱਕਿਆ ਹੈ ਹੁਣ ਕਾਲਜਾਂ ਦੇ ਵਿੱਚ ਵੀ ਪੰਜਾਬੀ ਜੋ ਹੈ ਇੱਕ ਲਾਜ਼ਮੀ ਵਿਸ਼ਾ ਬਣ ਚੁੱਕਿਆ ਹੈ ਕਿਉਂਕਿ ਕਾਲਜਾਂ ਦੇ ਵਿੱਚ ਵੀ ਬ ਬਾਰਵੀਂ ਤੋਂ ਬਾਅਦ ਦੀ ਪੜ੍ਹਾਈ ਦੇ ਵਿੱਚ ਵੀ ਪੰਜਾਬੀ ਇੱਕ ਜ਼ਰੂਰੀ ਵਿਸ਼ਾ ਹੈ ਹਰ ਜਮਾਤ ਦੇ ਵਿੱਚ ਪੰਜਾਬੀ ਵ ਨੂੰ ਇੱਕ ਵਿਸ਼ੇਸ਼ ਵਿਸ਼ਾ ਮੰਨਿਆ ਗਿਆ ਹੈ ਸਾਡੇ ਸਾਰੇ ਧਾਰਮਿਕ ਗ੍ਰੰਥ ਸਾਡਾ ਸਾਰਾ ਇਤਿਹਾਸ ਜੋ ਹੈ ਉਹ ਵੀ ਪੰਜਾਬੀ ਭਾਸ਼ਾ ਦੇ ਵਿੱਚ ਹੀ ਲਿਖਿਆ ਗਿਆ ਹੈ ਇਸ ਕਰਕੇ ਪੰਜਾਬੀ ਜੋ ਹੈ ਉਸਨੂੰ ਲਿਖਣ ਜਾਂ ਬੋਲਣ ਵੇਲੇ ਕਦੇ ਵੀ ਕਿਸ ਸਾਨੂੰ ਕੋਈ ਮੁਸ਼ਕਿਲ ਨਹੀਂ ਆਉਂਦੀ ਜਿੰਨੇ ਵੀ ਜਿੰਨੀ ਵੀ ਅਸੀਂ ਕਿਸੇ ਨੂੰ ਵੀ ਕੋਈ ਵੀ ਗੱਲ ਸਮਝਾਉਣੀ ਹੋਵੇ ਤਾਂ ਪੰਜਾਬੀ ਭਾਸ਼ਾ ਦੇ ਵਿੱਚ ਅਸੀਂ ਬੜੇ ਬੜੀ ਹੀ ਆਸਾਨੀ ਦੇ ਨਾਲ ਸਮਝਾ ਸਕਦੇ ਹਾਂ ਕੋਈ ਵੀ ਬੰਦਾ ਜੋ ਹੈ ਉਹ ਸਾਡੀ ਗੱਲ ਨੂੰ ਪੰਜਾਬੀ ਦੇ ਵਿੱਚ ਈਜ਼ੀਲੀ ਸਮਝਾ ਸਕਦਾ ਹੈ ਅਸੀਂ ਕੁਛ ਵੀ ਖਰੀਦਣਾ ਹੋਵੇ ਲੈਣ ਦੇਣ ਕਰਨਾ ਹੋਵੇ ਜਾਂ ਵਪਾਰ ਕਰਨਾ ਹੋਵੇ ਉਹਦੇ ਲਈ ਵੀ ਪੰਜਾਬੀ ਬੋਲੀ ਦੇ ਵਿੱਚ ਈਜ਼ੀਲੀ ਬੜੀ ਹੀ ਆਸਾਨੀ ਦੇ ਨਾਲ ਅਸੀਂ ਕਿਸੇ ਨੂੰ ਵੀ ਆਪਣੀ ਗੱਲ ਸਮਝਾ ਸਕਦੇ